ਇੱਕ ਚੰਗੀ ਖੁਰਾਕ ਲੈਣ ਦੇ ਲਈ ਸਭ ਤੋਂ ਪਹਿਲਾਂ ਇੱਕ ਇਨਸਾਨ ਦਾ ਚੰਗਾ ਪਾਚਣ ਤੰਤਰ ਆ ਜਿਹੜਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਤਾਂ ਕਿ ਉਸਨੂੰ ਹਜ਼ਮ ਕਰ ਸਕੇ ਅਤੇ ਉਹ ਕਿਵੇਂ ਹੋਵੇਗਾ ਉਹ ਹੋਵੇਗਾ ਖੇਡਣ ਨਾਲ ਕਸਰਤ ਕਰਨ ਨਾਲ ਭੱਜਣ ਨਾਲ ਤੰਦਰੁਸਤ ਰਹਿਣ ਨਾਲ ਬਾਕੀ ਆਪਾਂ ਖੁਰਾਕ 'ਤੇ ਆਉਂਦੇ ਹਾਂ ਖੁਰਾਕ ਸਭ ਤੋਂ ਪਹਿਲਾਂ ਮੈਂ ਕੀ ਖੁਰਾਕ ਲੈਂਦਾ ਸਭ ਤੋਂ ਪਹਿਲਾਂ ਮੈਂ ਉੱਠਦਾ ਉੱਠ ਕੇ ਪਹਿਲਾਂ ਮੈਂ ਪਾਣੀ ਪੀਂਦਾ ਦੋ ਗਲਾਸ ਦੋ ਗਲਾਸ ਪਾਣੀ ਪੀ ਕੇ ਫਿਰ ਇੱਕ ਕੱਪ ਚਾਹ ਦਾ ਪੀ ਕੇ ਫਿਰ ਮੈਂ ਖਾਂਦਾ ਦੋ ਆਂਡੇ ਦੋ ਆਂਡੇ ਖਾਣ ਤੋਂ ਬਾਅਦ ਮੈਂ ਦਲੀਆ ਬਣਾ ਲੈਂਦਾ ਇੱਕ ਕੌਲਾ ਭਰ ਕੇ ਦਲੀਆ ਦੇ ਖਾ ਲੈਂਦਾ ਅਤੇ ਫਿਰ ਮੈਂ ਦਸ ਵਜੇ ਰੋਟੀ ਖਾਂਦਾ ਰੋਟੀ ਪੂਰੀ ਵਧੀਆ ਖਾ ਕੇ ਰੋਟੀ ਫਿਰ ਮੈਂ ਦੁਪਹਿਰ ਮੈਂ ਸ਼ੇਕ ਬਣਾ ਲੈਂਦਾ ਸ਼ੇਕ ਬਣਾਉਣ ਤੋਂ ਬਾਅਦ ਫਿਰ ਮੈਂ ਇਸ ਤੋਂ ਅੱਗੇ ਥੋੜ੍ਹਾ ਜਿਹਾ ਚਾਹ ਪੀ ਕੇ ਚਾਹ ਦੇ ਨਾਲ ਫਿਰ ਮੈਂ ਚੌਲ ਖਾ ਲੈਂਦਾ ਚੌਲਾਂ ਦੇ ਨਾਲ ਦੋ ਦੋ ਆਂਡੇ ਹੋ ਜਾਂਦੇ ਆ ਹੋਰ ਫਿਰ ਸ਼ਾਮ ਨੂੰ ਮੈਂ ਪੰਜ ਕੁ ਵਜੇ ਸ਼ਾਮ ਨੂੰ ਪੰਜ ਵਜੇ ਫਿਰ ਮੈਂ ਦੋ ਤਿੰਨ ਕੇਲੇ ਖਾ ਲੈਂਦਾ ਕੇਲੇ ਫਿਰ ਮੈਂ ਜਿੰਮ ਚਲਾ ਜਾਂਦਾ ਜਿੰਮ ਤੋਂ ਆ ਕੇ ਫਿਰ ਮੈਂ ਆਉਣ ਸਾਰ ਕੇਲੇ ਖਾਂਦਾ ਕੇਲੇ ਖਾਣ ਤੋਂ ਉਪਰੰਤ ਮੈਂ ਰੋਟੀ ਖਾ ਕੇ ਫਿਰ ਮੈਂ ਸੌਂ ਜਾਂਦਾ ਧੰਨਵਾਦ ਜੀ